ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਜੀ ਅੱਛਾ ਜੀ ਹਾਂਜੀ ਜੀ ਅੱਛਾ ਅੱਛਾ ਜੀ ਅੱਛਾ ਕਿਸ ਤਰ੍ਹਾਂ ਦੇ ਬਰਤਨ ਚਾਹੀਦੇ ਜੀ ਤੁਹਾਨੂੰ ਅੱਛਾ ਜੀ ਅੱਛਾ ਜੀ ਅੱਛਾ ਕਾਹਦੇ 'ਚ ਲੈਣੇ ਹੈ ਜੀ ਲੋਹੇ 'ਚ ਲੈਣੇ ਹੈ ਤੁਸੀਂ ਕਿ ਸਟੀਲ 'ਚ ਲੈਣੇ ਕਾਹਦੇ 'ਚ ਲੈਣੇ ਹੈ ਜੀ ਅੱਛਾ ਜੀ ਅੱਛਾ ਹਾਂਜੀ ਠੀਕ ਹੈ ਜੀ ਅੱਛਾ ਠੀਕ ਹੈ ਜੀ ਠੀਕ ਹੈ

ਅੱਛਾ ਜੀ ਅੱਛਾ ਠੀਕ ਹੈ ਠੀਕ ਹੈ ਅਸੀਂ ਬਸ ਜੀ ਜਿਹੜਾ ਰੇਟ ਹੈਗਾ ਬਸ ਉਹੀ ਰੇਟ ਹੀ ਲਗਾ ਰਹੇ ਹਾਂ ਤਿੰਨ ਸੌ ਰੁਪਏ ਕਿਲੋ ਹੈ ਜੀ ਪਿੱਤਲ ਅਤੇ ਹਾਂਜੀ ਹਾਂਜੀ ਕਦੋਂ ਚਾਹੀਦੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ

ਅੱਛਾ ਠੀਕ ਹੈ ਜੀ ਠੀਕ ਹੈ ਜੀ ਕੋਈ ਨਾ ਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਵਧੀਆ ਕੁਆਲਿਟੀ ਦੇ ਮਿਲਣਗੇ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਕੱਲ੍ਹ ਦਸ ਵਜੇ ਖੁੱਲ੍ਹ ਜੂਗੀ ਜੀ ਦਸ ਵਜੇ ਆ ਜਿਓ ਠੀਕ ਹੈ ਜੀ ਹਾਂਜੀ ਹਾਂਜੀ ਚੱਲ ਠੀਕ ਹੈ ਜੀ ਆ ਜਿਓ ਕੋਈ ਨਾ

ਠੀਕ ਹੈ ਜੀ ਠੀਕ ਹੈ ਆ ਜਿਓ ਜੀ ਆ ਠੀਕ ਹੈ ਜੀ ਚਲੋ ਓਕੇ ਜੀ